ਪੰਜਾਬ ਵਿੱਚ ਬਹੁਤ ਤਰ੍ਹਾਂ ਦੇ ਕਾਰੋਬਾਰ ਕਰ ਸਕਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਡਿਟਰਜਨ ਪਾਊਡਰ ਬਣਾ ਸਕਦੇ ਹੋ ਇਹਨਾਂ ਪਾਉਡਰਾਂ ਦੇ ਉੱਤੇ ਬਹੁਤ ਘੱਟ ਖਰਚਾ ਆਉਂਦਾ ਹੈ ਬਣਾਉਣ ਵਿੱਚ ਔਰ ਇਹ ਕਾਫੀ ਮਹਿੰਗੇ ਬਣਦੇ ਵਿਕਦੇ ਹਨ ਤੁਹਾਡਾ ਮਕਸਦ ਤਾਂ ਸਿਰਫ ਪੈਸਾ ਕਮਾਉਣਾ ਹੀ ਹੈ ਇਸ ਲਈ ਘੱਟ ਖਰਚਾ ਔਰ ਜ਼ਿਆਦਾ ਪੈਸਾ ਮਿਲਣਾ ਹੀ ਫਾਇਦੇਮੰਦ ਸਿੱਧ ਹੁੰਦਾ ਹੈ ਉਸ ਤੋਂ ਬਾਅਦ ਲੋਕੀ ਕਿਸਾਨਾਂ ਕੰਮ ਵੀ ਬਹੁਤ ਕਰਦੇ ਹਨ ਫਿਰ ਉਸ ਤੋਂ ਬਾਅਦ ਟੂਰਿਜ਼ਮ ਦਾ ਵੀ ਕੰਮ ਬਹੁਤ ਹੈਗਾ ਇੱਥੋਂ ਤੁਸੀਂ ਲੋਕਾਂ ਨੂੰ ਦੇਸ਼ਾਂ ਪ੍ਰਦੇਸ਼ਾਂ 'ਚ ਭੇਜ ਸਕਦੇ ਹੋ ਔਰ ਤੁਹਾਡੇ ਉਹ ਆਪਣੇ ਕਾਗਜ਼ੀ ਕਾਰਵਾਈ ਨਾਲ ਹੀ ਬਹੁਤ ਘੱਟ ਖਰਚੇ ਨਾਲ ਹੀ ਤੁਸੀਂ ਉਹਨਾਂ ਕੋਲੋਂ ਬਹੁਤ ਜ਼ਿਆਦਾ ਪੈਸਾ ਲੈ ਸਕਦੇ ਹੋ ਅਤੇ ਤੁਸੀਂ ਕੰਮ ਕਰ ਸਕਦੇ ਹੋ ਸਾਡੇ ਇਸ ਤਰੀਕੇ ਕੰਮ ਕਰਨ ਨਾਲ ਸਾਡੇ ਭਾਰਤ ਦੇ ਵਾਧੂ ਕੰਮ ਆਉਣ ਨਾਲ ਬਹੁਤ ਅੱਗੇ ਤੱਕ ਜਾ ਸਕਦੇ ਨੇ ਕਾਰੋਬਾਰ ਸਾਡੇ ਪੰਜਾਬ ਦੇ ਨਾਲ ਸਾਰੇ ਹੋਰ ਹਿੰਦੁਸਤਾਨ ਜੁੜਿਆ ਹੋਇਆ ਹੈ ਕਈ ਚੀਜ਼ਾਂ ਤਾਂ ਅਸੀਂ ਐਕਸਪੋਰਟ ਵੀ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਸਪੋਰਟਸ ਗੁੱਡਸ ਇਹ ਬਹੁਤ ਜ਼ਿਆਦਾ ਵਿਕਦੇ ਹਨ ਔਰ ਪੰਜਾਬ ਦੇ ਹਰ ਉਹਦੇ ਵਿੱਚ ਮਸ਼ਹੂਰ ਹਨ ਕਿ ਜਾਂਦੇ ਹਨ ਹਰ ਤਰ੍ਹਾਂ ਦੇ ਦੇਸ਼ 'ਚ ਜਾਂਦੇ ਹਨ ਸਾਰੇ ਖਿਲਾੜੀ ਵੀ ਇਹਨਾਂ ਚੀਜ਼ਾਂ ਨਾਲ ਖੇਲਦੇ ਹਨ ਔਰ ਇਕ ਛੋਟਾ ਬੱਚਾ ਵੀ ਇੱਥੋਂ ਦਾ ਹੀ ਮੰਗਦਾ ਹੈ